ਹੈਲੋ ਹਾਂਜੀ ਸਿੰਧ ਸਟੂਡੀਓ ਤੋਂ ਬੋਲਦੇ ਹੋ ਹਾਂਜੀ ਸਰ ਆਪਣੇ ਨਾ ਇੱਥੇ ਮੈਰੀਜ ਦਾ ਵੈਸਟਨ ਪ੍ਰੋਗਰਾਮ ਹੈ ਅਤੇ ਡੇਟ ਲੈਂ ਉਹ ਲੈਣਾ ਤੁਹਾਡੇ ਤੋਂ ਪ੍ਰੋਗਰਾਮ ਕਰਵਾਉਣਾ ਸੀ ਉਹਦੇ ਬਾਰੇ ਦੱਸੋ ਹਾਂਜੀ ਹਾਂਜੀ ਦੱਸੋ ਆਪਣਾ ਉੱਨੀ ਜੂਨ ਦੋ ਹਜ਼ਾਰ ਚੌਵੀ ਨੂੰ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਦੋਨੇਂ ਦੋਨੇਂ ਦੋ ਦੋਨੇਂ ਜੀ ਦੋਨੇਂ ਜੀ ਅੱਛਾ ਜੀ ਹਾਂਜੀ ਕੀ ਇਹਨਾਂ ਦਾ ਰੇਟ ਹੈ ਜੀ ਕੀ ਫੋਟੋ ਦਾ ਕੀ ਅੱਛਾ ਜੀ ਹਾਂਜੀ ਅੱਛਾ ਜੀ ਅਤੇ ਇਹ ਰਹਿਤ ਹੋਊਗੀ ਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਅੱਛਾ ਜੀ ਠੀਕ ਹੈ ਜੀ ਅਤੇ ਬਸ ਇਹੀ ਸੀਗਾ ਤੁਸੀਂ ਮਾੜਾ ਜਿਹਾ ਮਾੜਾ ਮੋਟਾ ਉਹ ਹੋਜੂ

ਅੱਛਾ ਜੀ ਠੀਕ ਹੈ ਸਰ ਠੀਕ